ਮੇਰਾ ਨਾਮ ਅਰਵਿੰਦ ਹੈਗਾ ਅਤੇ ਮੈਂ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਅਤੇ ਮੈਨੂੰ ਜਿਵੇਂ ਮੈਂ ਗੱਲ ਕਰਾਂ ਕਿ ਮੈਨੂੰ ਜਿਹੜੀਆਂ ਵੀਡੀਓ ਗੇਮਾਂ ਹੈਗੀਆਂ ਵੀਡੀਓ ਗੇਮਾਂ ਖੇਡਣਾ ਮੈਨੂੰ ਬਹੁਤ ਪਸੰਦ ਹੈਗਾ ਇਹਦੇ ਨਾਲ਼ ਇਹ ਬਚਪਨ ਤੋਂ ਹੀ ਮੈਨੂੰ ਬਹੁਤ ਪਸੰਦ ਪਸੰਦ ਹੈਗਾ ਕਿ ਮੈਂ ਵੀਡੀਓ ਗੇਮਾਂ ਖੇਡਾਂ ਅਤੇ ਇਸ ਕਰਕੇ ਮੈਂ ਜਦੋਂ ਵੀ ਕੋਈ ਵੀਡੀਓ ਗੇਮ ਜਾਂ ਕੁਛ ਵੀ ਜਦੋਂ ਬਜ਼ਾਰ ਵਿੱਚ ਲੋਂਚ ਹੁੰਦੀ ਹੈਗੀ ਹੈ ਤਾਂ ਮੈਂ ਉਹ ਖਰੀਦ ਲੈਂਦਾ ਹੈਗਾ ਜੇ ਫ਼ੋਨ ਵਿੱਚ ਤਾਂ ਫਿਰ ਮੈਂ ਫ਼ੋਨ ਵਿੱਚੋਂ ਔਰਡਰ ਕਰ ਲੈਂਦਾ ਜਾਂ ਕੋਈ ਫ਼ੋਨ 'ਚੋਂ ਗੇਮ ਹੋਵੇ ਤਾਂ ਮੈਂ ਉਹ ਇੰਸਟੋਲ ਕਰ ਲੈਂਦਾ ਅਤੇ ਇਹ ਜਿਹੜੀਆਂ ਗੇਮਾਂ ਹੈਗੀਆਂ ਵਾ ਪੀ ਸੀ ਵਿੱਚ ਖੇਡਦਾ ਹੈਗਾ ਅਤੇ ਮੈਨੂੰ ਜਿਹੜਾ ਗੇਮਾਂ ਦਾ ਹੈਗਾ ਮੈਨੂੰ ਇਹਦੇ ਵਿੱਚ ਵੀ ਬਹੁਤ ਇੰਟਰਸਟ ਹੈਗਾ ਅਤੇ ਇਹ ਜਿਹੜੀਆਂ ਗੇਮਾਂ ਵਿੱਚ ਹੈਗਾ ਇਹਦੇ ਵਿੱਚ ਮੈਂ ਜਿਵੇਂ ਕਿ ਗੱਲ ਕਰਾਂ ਜਿਵੇਂ ਅੱਜ ਕੱਲ੍ਹ ਬਹੁਤ ਚੱਲ ਰਹੀ ਇੱਕ ਪਬਜੀ ਅਤੇ ਇੱਕ ਫਰੀ ਫਾਇਰ ਇਹ ਮੈਂ ਦੋਨਾਂ 'ਚ ਗੇਮਾਂ ਖੇਡਦਾ ਹੈਗਾ ਅਤੇ ਜਿਵੇਂ ਗੱਲ ਕਰਾਂ ਕਿ ਜਿਹੜੀ ਪਬਜੀ ਹੈਗੀ ਆ ਪਬਜੀ ਬਹੁਤ ਵਧੀਆ ਹੈਗੀ ਹੈ ਇਹਦੇ ਵਿੱਚ ਮੈਂ ਦਸ ਵੀਹ ਹਜ਼ਾਰ ਜਿਹੜੇ ਇਹ 'ਚ ਮੈਂ ਪੈਸੇ ਵੀ ਲਾਏ ਹੈਗੇ ਆ ਪਿੱਛੇ ਖੇਡਣਾ ਅਤੇ ਇਹਦੇ ਵਿੱਚ ਜਿਹੜੀ ਜਿਹੜੀ ਗੇਮ ਖੇਡਣੀ ਬੰਦੇ ਜਿਹੜੇ ਇੱਦਾਂ ਹੀ ਮਾ ਮਾਰਨੇ ਦੇ ਜਿਹੜੀਆਂ ਕੱਪੜੇ ਨਵੀਂ ਨਵੀਂ ਡਰੈੱਸਾਂ ਨਵੇਂ ਨਵੀਂ ਗਨਸ ਸਕਿਨਾਂ ਜਿਹੜੀਆਂ ਖੋਹਣੀਆਂ ਹੁੰਦੀਆਂ ਇਹ ਮੈਨੂੰ ਇਹਦੇ ਵਿੱਚ ਮੈਨੂੰ ਬੜਾ ਵਧੀਆ ਲੱਗਦਾ ਹੈਗਾ ਅਤੇ ਜਾਂ ਜਿੱਦਾਂ ਕਿ ਜਿਹਦੇ ਮੈਪ ਮੂਪ ਜਿਹੜੇ ਹੁੰਦੇ ਹੈਗੇ ਇਹ ਬਹੁਤ ਵਧੀਆ ਹੁੰਦੇ ਆ ਅਤੇ ਇਸ ਤੋਂ ਬਾਅਦ ਜਿਹੜੀ ਮੈਂ ਗੱਲ ਕਰਾਂ ਕਿ ਪ ਫਰੀ ਫਾਇਰ ਫਰੀ ਫਾਇਰ ਵੀ ਇੱਕ ਬਹੁਤ ਵਧੀਆ ਇੱਕ ਗੇਮ ਪਲੇਟਫਾਰਮ ਹੈਗਾ ਇਹ ਬ ਬ ਬੜੀ ਹੀ ਵਧੀਆ ਹੈਗੀ ਇਹ ਅੱਜ ਕੱਲ੍ਹ ਦੇ ਬੱਚੇ ਵੀ ਬਹੁਤ ਖੇਡਦੇ ਹੈਗੇ ਆ ਅਤੇ ਇਹ ਇਹਦੇ ਵਿੱਚ ਪੈਸੇ ਵੀ ਖਰਚ ਰਿਹਾ ਇਹਦੇ ਵਿੱਚ ਮੈਂ ਕਿਤੇ ਤੀਹ ਤੀਹ ਪੈਂਤੀ ਹਜ਼ਾਰ ਰੁਪਇਆ ਹੈਗਾ ਲਾਇਆ ਹੋਇਆ ਗੇਮ 'ਚ ਇਹਦੇ ਵਿੱਚ ਮੈਂ ਜਿਹੜੇ ਹੈਗੇ ਆ ਮੈਨੂੰ ਜਿਹੜਾ ਹੈਗਾ ਕਿ ਡਾਇਮੰਡ ਖਰੀਦਣ ਦਾ ਬਹੁਤ ਸ਼ੌਕ ਹੈਗਾ ਕਿ ਡਾਇਮੰਡ ਖਰੀਦਾਂ ਜਿਹੜੀਆਂ ਨਵੀਂ ਨਵੀਂ ਡਰੈੱਸਾਂ ਗਨਸ ਸਕਿਨਾਂ ਕਾਰ ਦੀ ਸਕਿਨਾਂ ਜਾਂ ਹੋਰ ਵਾਰ ਜਾਂ ਮੈਪ ਮੂਪ ਇਹਦੇ ਵਿੱਚ ਮੈਨੂੰ ਇਹ ਕਰਨ ਦਾ ਮੈਨੂੰ ਬੜਾ ਸ਼ੌਕ ਹੈਗਾ ਕਿ ਮੈਂ ਕੁਝ ਵੱਧ ਤੋਂ ਵੱਧ ਗਨਸ ਸਕਿਨਾਂ ਹੋਣ ਤਾਂ ਕਰਕੇ ਮੈਂ ਇਹ ਗੇਮ ਬਹੁਤ ਖੇਡਦਾ ਹੈਗਾ ਇਹ ਮੈਂ ਫਰੀ ਟਾਈਮ 'ਤੇ ਜਾਂ ਜ਼ਿਆਦਾ ਤੋਂ ਜ਼ਿਆਦਾ ਗੇਮਾਂ ਖੇਡਦਾ ਇਹ ਜਿਹੜੀਆਂ ਗੇਮਾਂ ਖੇਡਣੀਆਂ ਹੁੰਦੀਆਂ ਮੈਨੂੰ ਬੜੀਆਂ ਹੀ ਪਸੰਦ ਹੈਗੀਆਂ ਇਹ ਮੈਂ ਰਾਤ ਪੰਜ ਤਿੰਨ ਵਜੇ ਤੱਕ ਗੇਮਾਂ ਹੀ ਖੇਡਦਾ ਰਹਿੰਦਾ ਇਹ ਮੈਨੂੰ ਗੇਮਾਂ ਖੇਡਣਾ ਬਹੁਤ ਪਸੰਦ ਹੈਗਾ ਹੈ ਜਿਸ ਕਰਕੇ ਮੈਂ ਸਾਰਿਆਂ ਨੂੰ ਇਹ ਕਹਿੰਦਾ ਕਿ ਹਰ ਫਰੀ ਟਾਈਮ ਦੇ ਵਿੱਚ ਗੇਮਾਂ ਖੇਡੋ ਅਤੇ ਧੰਨਵਾਦ